ਪੇਂਡੂ ਖੇਤਰਾਂ ਵਿੱਚ ਕਿਸਾਨਾਂ ਨੂੰ ਬਹੁਤ ਜ਼ਿਆਦਾ ਮੁੱਦਿਆਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਸਾਰੀਆਂ ਚੁਨੌਤੀਆਂ ਨੇ ਜਦੋਂ ਇੱਕ ਛੋਟਾ ਕਿਸਾਨ ਹੁੰਦਾ ਪਹਿਲਾਂ ਤਾਂ ਉਹਦੇ ਕੋਲ ਸਿਖਲਾਈ ਨਹੀਂ ਹੁੰਦੀ ਕਿ ਕਿਸ ਤਰ੍ਹਾਂ ਖੇਤੀ ਕਰਨੀ ਹੈ ਕਿਉਂਕਿ ਉਹਦੇ ਕੋਲ ਸਾਧਨ ਹੀ ਨਹੀਂ ਹੈਗੇ ਉਹਦੇ ਕੋਲ ਉਨੇ ਸੰਦ ਹੀ ਨਹੀਂ ਹੈਗੇ ਕਿ ਉਹ ਖੇਤੀ ਪੂਰੀ ਤਰ੍ਹਾਂ ਕਰ ਸਕੇ ਦੂਜਾ ਇਹ ਹੋ ਜਾਂਦਾ ਕਿ ਉਹਦੇ ਕੋਲ ਵਿੱਤੀ ਸਾਧਨ ਵਿੱਤੀ ਸਹਾਇਤਾ ਉਹਦੇ ਕੋਲ ਇੰਨਾ ਪੈਸਾ ਹੀ ਨਹੀਂ ਕਿ ਉਹ ਪੈਸਾ ਲੈ ਕੇ ਖੇਤੀ ਕਰ ਸਕੇ ਅਗਰ ਉਹ ਬੈਂਕ ਤੋਂ ਕਰਜ਼ਾ ਲੈਂਦਾ ਵੀ ਹੈ ਤਾਂ ਫਿਰ ਜਦੋਂ ਬੈਂਕ ਦਾ ਕਰਜ਼ਾ ਨਹੀਂ ਵਾਪਸ ਕਰ ਪਾਉਂਦਾ ਤਾਂ ਫਿਰ ਉਹ ਦੇਖਣ 'ਚ ਆਉਂਦਾ ਹੀ ਹੈ ਕਿੰਨੀਆਂ ਆਪਾਂ ਖਬਰਾਂ ਪੜ੍ਹਦੇ ਹਾਂ ਕਿ ਕਿਸੇ ਕਿਸਾਨ ਦਾ ਕਰਜ਼ਾ ਨਹੀਂ ਸੀ ਵਾਪਸ ਹੋਇਆ ਤਾਂ ਉਹਨੇ ਆਤਮਹੱਤਿਆ ਕਰ ਲਈ ਉਹ ਇੰਨਾ ਦੁਖੀ ਹੋ ਜਾਂਦਾ ਹੈ ਕਿ ਉਹ ਆਤਮਹੱਤਿਆ ਹੀ ਕਰ ਲੈਂਦਾ ਏ ਅਤੇ ਫਿਰ ਮੌਸਮ ਦੀ ਤਬਦੀਲੀ ਜਿੱਦਾਂ ਕਿ ਦੇਖੋ ਕਣਕ ਜਦੋਂ ਕਣਕ ਦੀ ਬਿਜਾਈ ਕਰਦੇ ਹੈ ਉਦੋਂ ਤਾਂ ਮੌਸਮ ਬਹੁਤ ਵਧੀਆ ਹੁੰਦਾ ਏ ਜਿਸ ਟਾਈਮ ਕਣਕ ਦੀ ਕਟਾਈ ਕਰਨ ਦਾ ਸਮਾਂ ਆਉਂਦਾ ਏ ਉਸ ਟਾਈਮ ਬਾਰਿਸ਼ ਆ ਜਾਂਦੀ ਹੈ ਜਦੋਂ ਬਾਰਿਸ਼ ਆਉਂਦੀ ਉਹ ਬੇ ਅਤਾਹ ਆ ਜਾਂਦੀ ਹੈ ਕਿ ਉਹਨੂੰ ਸਾ ਕਿਉਂਕਿ ਦੇਖੋ ਬਾਰਿਸ਼ ਤਾਂ ਇੱਕ ਕੁਦਰਤੀ ਹੈ ਉਹਨੂੰ ਅਸੀਂ ਰੋਕ ਨਹੀਂ ਸਕਦੇ ਤਾਂ ਫਿਰ ਉਹਦੇ ਨਾਲ ਫਸਲਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਉਹ ਜਿਹੜੇ ਛੋਟੇ ਕਿਸਾਨ ਆ ਵਿਚਾਰੇ ਜਿਨ੍ਹਾਂ ਨੇ ਖੇਤੀ ਕੀਤੀ ਹੈ ਉਹਨਾਂ ਦਾ ਤਾਂ ਨੁਕਸਾਨ ਹੋ ਜਾਂਦਾ ਉਹ ਸਾਰੀ ਕਣਕ ਜਿਹੜੀ ਉਹਨਾਂ ਦੀ ਉਹ ਪਾਣੀ 'ਚ ਬਹਿ ਜਾਂਦੀ ਹੈ ਜਾਂ ਫਿਰ ਉਹ ਕਾਲੀ ਹੋ ਜਾਂਦੀ ਹੈ ਜਾਂ ਫਿਰ ਉਹ ਘੱਟ ਹੁੰਦੀ ਹੈ ਤਾਂ ਉਹਦੇ ਨਾਲ਼ ਉਹਦਾ ਨੁਕਸਾਨ ਹੁੰਦਾ ਜਿੰਨਾਂ ਉਹਨੇ ਵਿਚਾਰੇ ਨੇ ਉਹਦੇ 'ਤੇ ਪੈਸਾ ਲਾਇਆ ਉਹ ਤਾਂ ਉਹਨੂੰ ਮਿਲਦਾ ਹੀ ਨਹੀਂ ਉਸ ਤੋਂ ਬਾਅਦ ਜਿਹੜੀ ਤਕਨੀਕੀ ਸਹਾਇਤਾ ਉਹਦੇ ਕੋਲ ਤਕਨੀਕ ਸਹਾਇਤਾ ਨਹੀਂ ਕਿਉਂਕਿ ਉਹ ਕਈ ਇੱਦਾਂ ਦੇ ਕਿਸਾਨ ਜਿਹੜੇ ਪੜ੍ਹੇ ਹੀ ਨਹੀਂ ਹੈਗੇ ਜਿਨਾਂ ਨੂੰ ਪਤਾ ਹੀ ਨਹੀਂ ਹੈਗਾ ਤਕਨੀਕੀ ਬਾਰੇ ਉਹ ਕਿੱਦਾਂ ਤਕਨੀਕ ਨੂੰ ਯੂਜ ਕਰੂੰਗੇ ਕਿੱਦਾਂ ਉਹ ਫਿਰ ਇਸ ਤਰਾਂ ਉਹ ਪਿੱਛੇ ਰਹਿ ਜਾਂਦੇ ਨੇ ਫਿਰ ਉਨਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਇੱਦਾਂ ਦੀਆਂ ਆਉਂਦੀਆਂ ਨੇ ਫਿਰ ਕਿਸਾਨਾਂ ਨੂੰ ਸਿਖਲਾਈ ਨਹੀਂ ਦਿੱਤੀ ਜਾਂਦੀ ਜਿਹੜੇ ਛੋਟੇ ਪੱਧਰ 'ਤੇ ਕਿਸਾਨ ਹੈ ਉਨ੍ਹਾਂ ਵਿਚਾਰਿਆਂ ਬਾਰੇ ਕੋਈ ਸਿਖਲਾਈ ਨਹੀਂ ਇਸ ਕਰਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਮੈਂ ਕਹਿੰਦੀ ਹਾਂ ਕਿ ਸਰਕਾਰ ਨੂੰ ਇਨ੍ਹਾਂ ਚੁਣੌਤੀਆਂ ਨੂੰ ਦੂਰ ਕਰਨਾ ਚਾਹੀਦਾ ਹੈ ਉਹਨਾਂ ਦੀ ਕਿਤੇ ਨਾ ਕਿਤੇ ਹੈਲਪ ਕਰਨੀ ਚਾਹੀਦੀ ਹੈ ਸਰਕਾਰ ਨੂੰ